ਬੁਣਾਈ ਅਤੇ ਸਿਲਾਈ ਨੇ ਇੱਕ ਰਚਨਾਤਮਕ ਆਊਟਲੈਟ ਅਤੇ ਇੱਕ ਵਿਹਾਰਕ ਹੁਨਰ ਪ੍ਰਦਾਨ ਕਰਕੇ ਮੇਰੇ ਜੀਵਨ ਨੂੰ ਮਹੱਤਵਪੂਰਨ ਤੌਰ 'ਤੇ ਪ੍ਰਭਾਵਿਤ ਕੀਤਾ ਹੈ ਇਹਨਾਂ ਸ਼ਿਲਪਕਾਰੀ ਵਿੱਚ ਰੁੱਝੇ ਰਹਿਣ ਨਾਲ ਪ੍ਰਾਪਤੀ ਅਤੇ ਤਣਾਅ ਤੋਂ ਰਾਹਤ ਦੀ ਭਾਵਨਾ ਆਈ ਹੈ ਜੋ ਮੇਰੀ ਰੋਜ਼ਾਨਾ ਰੂਟੀਨ ਨੂੰ ਫੋਕਸ ਅਤੇ ਧਿਆਨ ਨਾਲ ਭਰਪੂਰ ਬਣਾਉਂਦਾ ਹੈ ਵਿੱਤੀ ਤੌਰ 'ਤੇ ਵਾਪਸੀ ਮਾਮੂਲੀ ਰਹੀ ਹੈ ਜੋ ਅਕਸਰ ਮਹੱਤਵਪੂਰਨ ਲਾਭ ਪੈਦਾ ਕਰਨ ਦੀ ਬਜਾਏ ਲਾਗਤਾਂ ਨੂੰ ਕਵਰ ਕਰਦੀ ਹੈ ਹਾਲਾਂਕਿ ਕੁਝ ਵਿਲੱਖਣ ਬਣਾਉਣ ਦੀ ਖੁਸ਼ੀ ਮੁਦਰਾ ਪਹਿਲੂ ਤੋਂ ਵੱਧ ਹੈ ਸਰੀਰਕ ਤੌਰ 'ਤੇ ਮੈਂ ਬੁਣਾਈ ਅਤੇ ਸਿਲਾਈ ਦੇ ਲੰਬੇ ਸਮੇਂ ਤੋਂ ਕੁਝ ਬੇਆਰਾਮੀ ਦਾ ਅਨੁਭਵ ਕੀਤਾ ਹੈ ਜਿਵੇਂ ਕਿ ਵਾਰ ਵਾਰ ਤਣਾਅ ਦੀਆਂ ਸੱਟਾਂ ਜਾਂ ਹੱਥਾਂ ਦੀ ਥਕਾਵਟ ਇਸਦਾ ਪ੍ਰਬੰਧਨ ਕਰਨ ਲਈ ਮੈਂ ਐਰਗੋਨੀ ਤਕਨੀਕਾਂ ਦਾ ਅਭਿਆਸ ਕਰਦਾ ਹਾਂ ਅਤੇ ਤਣਾਅ ਨੂੰ ਰੋਕਣ ਲਈ ਨਿਯਮਤ ਬਰੇਕ ਲੈਂਦਾ ਹਾਂ ਕੁਲ ਮਿਲਾ ਕੇ ਜਦੋਂ ਕਿ ਬੁਣਾਈ ਅਤੇ ਸਿਲਾਈ ਵਿੱਚ ਕੁਝ ਚੁਣੌਤੀਆਂ ਸ਼ਾਮਿਲ ਹੁੰਦੀਆਂ ਹਨ ਉਹਨਾਂ ਦੁਆਰਾ ਪੇਸ਼ ਕੀਤੀ ਗਈ ਨਿੱਜੀ ਸੰਤੁਸ਼ਟੀ ਅਤੇ ਰਚਨਾਤਮਕ ਪੂਰਤੀ ਬਹੁਤ ਫਲਦਾਇਕ ਰਹੀ ਹੈ